ਮੈਂ ਸਵੇਰੇ ਜਲਦੀ ਉੱਠ ਕੇ ਸੈਰ ਕਰਨ ਲਈ ਜਾਂਦਾ ਹਾਂ ਇਸ ਦੌਰਾਨ ਮੈਂ ਰਨਿੰਗ ਅਤੇ ਯੋਗਾ ਵੀ ਕਰਦਾ ਹਾਂ ਅਤੇ ਸਵੇਰ ਦੀ ਹਵਾ ਸਿਹਤ ਲਈ ਬਹੁਤ ਹੀ ਫ਼ਾਇਦੇਮੰਦ ਹੁੰਦੀ ਹੈ ਮੈਂ ਸਵੇਰੇ ਅਜਿਹਾ ਕਰਨ ਨਾਲ਼ ਸਾਰਾ ਦਿਨ ਥਕਾਵਟ ਨਹੀਂ ਹੁੰਦੀ ਅਤੇ ਚੁਸਤੀ ਪਈ ਰਹਿੰਦੀ ਹੈ ਸ਼ਾਮ ਵੇਲੇ ਮੈਂ ਆਪਣੀ ਪਿੰਡ ਦੀ ਜਿੰਮ ਵਿੱਚ ਦੋ ਘੰਟੇ ਕਸਰਤ ਕਰਦਾ ਹਾਂ ਜਿਸ ਨਾਲ਼ ਮੇਰਾ ਸਰੀਰ ਤੰਦਰੁਸਤ ਰਹਿੰਦਾ ਹੈ ਅਤੇ ਬਿਮਾਰੀਆਂ ਤੋਂ ਦੂਰ ਰਹਿੰਦਾ ਹੈ ਬਾਕੀ ਮੈਂ ਆਪਣੇ ਖਾਣ ਪੀਣ ਦਾ ਵੀ ਪੂਰਾ ਧਿਆਨ ਰੱਖਦਾ ਹਾਂ ਮੈਂ ਜ਼ਿਆਦਾ ਤੇਲ ਵਾਲਾ ਖਾਣਾ ਨਹੀਂ ਖਾਂਦਾ ਅਤੇ ਘਰ ਦਾ ਬਣਿਆ ਹੀ ਖਾਣਾ ਖਾਂਦਾ ਹਾਂ ਮੈਂ ਪਾਣੀ ਦੀ ਮਾਤਰਾ ਵੀ ਪ੍ਰੋਪਰ ਲੈਂਦਾ ਹਾਂ ਮੈਂ ਆਪਣੇ ਕਰੀਅਰ ਦਾ ਫੈਸਲਾ ਆਪਣੇ ਅਧਿਆਪਕ ਤੋਂ ਲਿਆ ਹੈ ਉਹ ਉਹਨਾਂ ਨੂੰ ਆਪਣੇ ਇੰਟਰਸਟ ਬਾਰੇ ਦੱਸਿਆ ਅਤੇ ਬਾਕੀ ਉਹਨਾਂ ਨੂੰ ਮੇਰੇ ਬਾਰੇ ਵੱਧ ਜਾਣਦੇ ਹਨ ਤਾਂ ਉਹਨਾਂ ਨੇ ਮੈਨੂੰ ਸਹੀ ਫੈਸਲਾ ਦਿੱਤਾ ਮੇਰਾ ਕਰੀਅਰ ਦਾ ਮਾਰਗ ਹੈ ਕਿ ਮੈਂ ਇੱਕ ਵਧੀਆ ਅਧਿਆਪਕ ਬਣਾ